ਸਧਾਰਨ ਪੰਛੀ ਜਾਂ ਦੁਰਲਭ ਪੰਛੀ ਕਹਿ ਲਈਏ ਤਾਂ ਇਹ ਉਹ ਪੰਛੀ ਨੇ ਜਿਹੜੇ ਕਿ ਪਹਿਲਾਂ ਵਾਲੇ ਸਮੇਂ ਵਿੱਚ ਬਹੁਤ ਕਾਫੀ ਦਿਸਦੇ ਸਨ ਉੱਡਦੇ ਆਪਾਂ ਨੂੰ ਆਮ ਹੀ ਦਿਸਦੇ ਸਨ ਜਿਵੇਂ ਕਿ ਚਿੜੀਆਂ ਹੋ ਗਈਆਂ ਉੱਲੂ ਹੋ ਗਏ ਰਾਤ ਦੇ ਸਮੇਂ ਚਮਗਿੱਦੜ ਹੋ ਗਏ ਜਾਂ ਚਮਚੜਿੱਕਾਂ ਹੋ ਗਈਆਂ ਹੋਰ ਵੀ ਇਸ ਤਰ੍ਹਾਂ ਦੇ ਕਈ ਪੰਛੀ ਨੇ ਕਾਂ ਹੋ ਗਏ ਕਾਂ ਬਹੁਤ ਘੱਟ ਰਹੇ ਨੇ ਅਤੇ ਇਸ ਹੀ ਤਰ੍ਹਾਂ ਜਿਹੜੇ ਕਿ ਹੁਣ ਉਹ ਦਿੱਖ ਨਹੀਂ ਰਹੇ ਹੈ ਨਾ ਕਿਉਂਕਿ ਉਹਨਾਂ ਦੀ ਦਿਨੋ ਦਿਨ ਜਿਹੜੀ ਹੈਗੀ ਆ ਪ੍ਰਜਾਤੀ ਘਟਦੀ ਜਾ ਰਹੀ ਹੈ ਵੀ ਉਹ ਬਹੁਤ ਘੱਟ ਦਿਖਣੇ ਨੇ ਅੱਗੇ ਚਿੜੀਆਂ ਸ਼ਾਮ ਨੂੰ ਦਰਖਤਾਂ 'ਤੇ ਇਸ ਟ ਜਾਣੀ ਕਿ ਸ਼ਾਮ ਦੇ ਵੇਲੇ ਪੰਜ ਤੋਂ ਬਾਅਦ ਅਤੇ ਬਹੁਤ ਸ਼ੋਰ ਕਰਦੀਆਂ ਸੀਗੀਆਂ ਅਤੇ ਦੇਖਣ ਨੂੰ ਆਮ ਹੀ ਮਿਲਦੀਆਂ ਸੀ ਘਰਾਂ ਦੇ ਵਿੱਚ ਅਤੇ ਪਰ ਅੱਜ ਕੱਲ ਕੀ ਹੈ ਵੀ ਚਿੜੀਆਂ ਦਿਨੋ ਦਿਨ ਅਲੋਪ ਹੋ ਰਹੀਆਂ ਬਹੁਤ ਘੱਟ ਦੇਖਣ ਨੂੰ ਮਿਲ ਰਹੀਆਂ ਅਤੇ ਆਉਣ ਵਾਲੇ ਸਮੇਂ 'ਚ ਇੱਕ ਨਾ ਇੱਕ ਦਿਨ ਇਹ ਜਮ੍ਹਾਂ ਹੀ ਘੱਟ ਜਾਣਗੀਆਂ ਵੀ ਦੇਖਣ ਨੂੰ ਨਹੀਂ ਮਿਲਣੀਆਂ ਕਾਰਨ ਕਾਰਨ ਇਹ ਵੀ ਕਹਿ ਸਕਦੇ ਜਿਹੜੇ ਨੈਟਵਰਕ ਮੋਬਾਇਲ ਜ਼ਿਆਦਾ ਚੱਲ ਪਏ ਟਾਵਰ ਜ਼ਿਆਦਾ ਲੱਗ ਗਏ ਵਾਈਫਾਈ ਜ਼ਿਆਦਾ ਲੱਗ ਗਏ ਕਿਉਂਕਿ ਅੱਗੇ ਇਹ ਚੀਜ਼ਾਂ ਬਹੁਤ ਘੱਟ ਸੀ ਰੇਂਜ ਦੇ ਸਾਧਨ ਬਹੁਤ ਘੱਟ ਸੀਗੇ ਤਾਰਾਂ ਵਾਲੇ ਫੋਨ ਹੁੰਦੇ ਸੀਗੇ ਅਤੇ ਇਸਦੇ ਕਾਰਨ ਹੀ ਵੀ ਜਿਹੜਾ ਕਿ ਕੁਝ ਜਾਨਵਰਾਂ ਦੀਆਂ ਪ੍ਰਜਾਤੀਆਂ ਨੇ ਉਹ ਅਲੋਪ ਹੁੰਦੀਆਂ ਜਾ ਰਹੀਆਂ ਨੇ ਚਿੜੀਆਂ ਲਾ ਲਓ ਕਾਂ ਲਾ ਲਓ ਇਸ ਤਰ੍ਹਾਂ ਦੀਆਂ ਹੈ ਨਾ ਵੀ ਕੀ ਹੋ ਸਕਦਾ ਗਾ